ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਸ਼ੁਰੂ ਤੋਂ ਹੀ ਜਨਮ ਮੇਰਾ ਮਤਲਬ ਕਿ ਜਨਮ ਮੇਰਾ ਉਰੇ ਹੋਇਆ ਹੈ ਨਾ ਪੰਜਾਬ 'ਚ ਤਾਂ ਮੈਂ ਸ਼ੁਰੂ ਤੋਂ ਹੀ ਮਤਲਬ ਸਕੂਲ 'ਚ ਜਾਂਦੇ ਟਾਈਮ ਵੀ ਪੰਜਾਬੀ ਬੋਲਣਾ ਅਤੇ ਚੰਗੀ ਤਰ੍ਹਾਂ ਬੋਲਣੀ ਹੈ ਨਾ ਸਕੂਲ 'ਚ ਮੈਂ ਜਿੱਦਾਂ ਜਾਂਦੇ ਹੀ ਅਤੇ ਸਾਡੀ ਮੰਮੀ ਮੇਰੀ ਮੰਮੀ ਨੇ ਮਤਲਬ ਕਿ ਪੰਜਾਬੀ ਸਬਜੈਕਟ ਰਖਵਾਇਆ ਕਿ ਹਾਂ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਭਾਸ਼ਾ ਹੈ ਹੈ ਨਾ ਬਹੁਤ ਚੰਗੀ ਭਾਸ਼ਾ ਮਤਲਬ ਬੰਦੇ ਨੂੰ ਬੋਲਣ 'ਚ ਵੀ ਚੰਗੀ ਲੱਗਦੀ ਸੁਣਨ 'ਚ ਵੀ ਹੈ ਨਾ ਅਤੇ ਮੈਂ ਸ਼ੁਰੂ ਤੋਂ ਪੰਜਾਬੀ ਸਬਜੈਕਟ ਰੱਖਿਆ ਮਤਲਬ ਕਿ ਮੈਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਪੰਜਾਬੀ ਰੱਖਿਆ ਜਦ ਮੈਂ ਸਕੂਲ ਚੇਂਜ ਕੀਤਾ ਪਲੱਸ ਉਹ ਤੋਂ ਬਾਅਦ ਵੀ ਮੈਂ ਪੰਜਾਬੀ ਮਤਲਬ ਸਬਜੈਕਟ ਹੀ ਚੁਣਿਆ ਕੋਈ ਭੇਦਭਾਵ ਨਹੀਂ ਕੀਤਾ ਕਿ ਹਾਂ ਇੰਗਲਿਸ਼ ਮੈਨੂੰ ਬੰਦੇ ਰਹਿੰਦੀ ਨਹੀਂ ਬੰਦੇ ਦੀ ਜੋ ਪੰਜਾਬੀ ਹੈ ਨਾ ਇੱਕ ਤਰ੍ਹਾਂ ਨਾਲ਼ ਖੁੱਲ੍ਹੀ ਜਾਂਦੀ ਭਾਸ਼ਾ ਮਤਲਬ ਭਾਸ਼ਾ ਵਧੀਆ ਭਾਸ਼ਾ ਜਿਸ 'ਚ ਬੰਦੇ ਨੂੰ ਬੋਲਣ 'ਚ ਵੀ ਔਰ ਸੁਣਨ 'ਚ ਵੀ ਚੰਗੀ ਲੱਗਦੀ ਜਿੱਦਾਂ ਕਿ ਮੈਂ ਇਹ ਤੋਂ ਬਾਅਦ ਕੀਤਾ ਉਹ ਤੋਂ ਬਾਅਦ ਫਿਰ ਮੈਂ ਹੁਣ ਕੋਲੇਜ ਵੀ ਜੁਆਇਨ ਕੀਤਾ ਆਫਟਰ ਕੋਲਿਜ ਪਲੱਸ ਟੂ ਬਾਅਦ ਜੁਆਇਨ ਕੀਤਾ ਅਤੇ ਉਹ ਤੋਂ ਬਾਅਦ ਫਿਰ ਮੈਂ ਆਪਣੇ ਪੰਜਾਬੀ ਸਬਜੈਕਟ ਹੀ ਚੁਣੇ ਸਾਰੇ ਮਤਲਬ ਕੋਈ ਮਤਲਬ ਇੱਦਾਂ ਨਹੀਂ ਕਿ ਮੈਂ ਇੰਗਲਿਸ਼ ਮੀਡੀਅਮ ਰੱਖਿਆ ਜੋ ਮੈਨੂੰ ਕਿਉਂਕਿ ਸਾਡੀ ਪੰਜਾਬੀ ਹੈ ਹੀ ਬੋਲ ਪੰਜਾਬੀ ਮਤਲਬ ਆਪਣੀ ਮਾਂ ਬੋਲੀ ਭਾਸ਼ਾ ਹੈ ਨਾ ਸਾਨੂੰ ਰੱਖਣੀ ਚਾਹੀਦੀ ਹੈ ਮਤਲਬ ਕਿ ਹਰ ਕਿਸੇ ਬੰਦੇ ਨੂੰ ਹੋਣੀ ਚਾਹੀਦੀ ਕਿ ਹਾਂ ਅਸੀਂ ਪੰਜਾਬੀ ਬੋਲੀਏ ਇਹ ਨਹੀਂ ਕਿ ਅਸੀਂ ਇੰਗਲਿਸ਼ ਵੱਲ ਜਾਈਏ ਅਤੇ ਇਸ ਕਰਕੇ ਮੈਂ ਪੰਜਾਬੀ ਭਾਸ਼ਾ ਆਪਣੇ ਮਤਲਬ ਕਿ ਰੱਖੀ ਹੈ ਨਾ ਹੁਣ ਤਾਂ ਮੈਂ ਮਤਲਬ ਕਿ ਪੰਜਾਬੀ ਮੈਨੂੰ ਭਾਸ਼ਾ ਬਹੁਤ ਪਿਆਰੀ ਲੱਗਦੀ ਹੈ ਮਤਲਬ ਬਹੁਤ ਚੰਗੀ ਕਿ ਬੰਦੇ ਨੂੰ ਸੁਣਨ 'ਚ ਵੀ ਚੰਗੀ ਰਿਸਪੈਕਟਫੁੱਲ ਇੱਜ਼ਤਦਾਰ ਭਾਸ਼ਾ ਮਤਲਬ ਕਹਿਣ ਦਾ ਭਾਵ ਕੀ ਕਿ ਬੰਦੇ ਨੂੰ ਖੁਸ਼ ਹੋ ਜਾਂਦਾ ਬੰਦਾ ਮਤਲਬ ਕਿ ਹੈ ਨਾ ਇੱਦਾਂ ਤੁਸੀਂ ਬੋਲਣਾ ਚੰਗੀ ਤਰ੍ਹਾਂ ਪਿਆਰ ਨਾਲ਼ ਬੋਲਣਾ ਅਤੇ ਮਤਲਬ ਕਿ ਬਹੁਤ ਪਿਆਰੀ ਲੱਗਦੀ ਭਾਸ਼ਾ ਮੈਨੂੰ ਬੋਲਣ 'ਚ ਨਾ ਕੋਈ ਦਿੱਕਤ ਆਉਂਦੀ ਬੰਦੇ ਨੂੰ ਬੋਲਣ 'ਚ ਹੈ ਨਾ ਅਤੇ ਕੋਈ ਜਿੱਦਾਂ ਸੁਣਦਾ ਤਾਂ ਉਹ ਵੀ ਕਹਿੰਦਾ ਹਾਂਜੀ ਕਿ ਬੰਦਾ ਮਤਲਬ ਕਿ ਪੜ੍ਹਿਆ ਬੰਦਾ ਵਧੀਆ ਏ ਕਿ ਹਾਂ ਜਿੱਦਾਂ ਕਿ ਬੋਲਦਾ ਪੰਜਾਬੀ ਭਾਸ਼ਾ ਚੰਗੀ ਵੀ ਲੱਗਦੀ ਬੋਲਣ ਨੂੰ ਕੀ ਮਤਲਬ ਕਿ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਪੰਜਾਬੀ ਭਾਸ਼ਾ ਨਾਲ਼ ਆਪਣਾ ਜੁੜਿਆ ਰਹਿਣਾ ਚਾਹੀਦਾ ਹਨਾ ਪੰਜਾਬੀ ਪੰਜਾਬ ਪੰਜਾਬ 'ਚ ਰਹਿਣ ਵਾਲੇ ਨੂੰ ਪੰਜਾਬੀ ਜੁੜੇ ਰਹਿਣਾ ਚਾਹੀਦਾ ਹੈ ਹੈ ਨਾ ਹਾਂ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕੀ ਮੈਂ ਹੁਣ ਹਰ ਕੋਈ ਮਤਲਬ ਆਪਣੇ ਪੰਜਾਬ 'ਚ ਬਹੁਤ ਲੋਕ ਆ ਜਿਹੜੇ ਘੱਟ ਹੀ ਬੋਲਦੇ ਆ ਹੈ ਨਾ ਪੰਜਾਬੀ ਅਤੇ ਇੰਗਲਿਸ਼ ਵੱਲ ਜ਼ਿਆਦਾ ਜਾਂਦੇ ਤਾਂ ਸਾਨੂੰ ਮਤਲਬ ਕਿ ਇਹ ਚੀਜ਼ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਅਸੀਂ ਪੰਜਾਬ 'ਚ ਜਨਮ ਲਿਆ ਤਾਂ ਸਾਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਆ ਹੈ ਨਾ ਪੰਜਾਬੀ ਸਬਜੈਕਟ ਅਤੇ ਹੁਣ ਮੈਂ ਸੋਚ ਰਿਹਾ ਕਿ ਹੁਣ ਮੈਂ ਜੇ ਪੀ ਐੱਚ ਡੀ ਵੀ ਕਰਨੀ ਤਾਂ ਉਹ 'ਚ ਮੈਂ ਪੰਜਾਬੀ ਸਬਜੈਕਟ ਆਪਣਾ ਰੱਖਾਂ ਹੈ ਨਾ ਅਤੇ ਅੱਗੇ ਪੰਜਾਬੀ ਹੋਰ ਜੁੜਿਆ ਰਹਾਂ ਧੰਨਵਾਦ